ਮੇਰਾ ਫੋਨ ਦੋ ਤਿੰਨ ਮਹੀਨਿਆਂ ਪਹਿਲਾਂ ਹੀ ਟੁੱਟਿਆ ਸੀ ਫਿਰ ਮੈਂ ਸੋਚਿਆ ਚਲੋ ਮੈਂ ਸਾਰ ਹੀ ਲੈਂਦੀ ਹਾਂ ਮਾਪਿਆਂ ਕੋਲ ਵੀ ਇੰਨੇ ਫਾਲਤੂ ਪੈਸੇ ਹੁੰਦੇ ਨਹੀਂ ਕਿ ਉਹ ਅੱਜ ਕੱਲ੍ਹ ਦੇ ਜਵਾਕਾਂ ਨੂੰ ਫ਼ੋਨ ਦਵਾ ਸਕੇ ਬਟ ਫ਼ਿਰ ਜਦ ਮੈਨੂੰ ਮੇਰੀ ਪੜ੍ਹਾਈ ਵਿੱਚ ਅਤੇ ਹੋਰ ਵੀ ਕੰਮਾਂ ਕਾਰਾਂ ਵਿੱਚ ਫੋਨ ਦੀ ਲੋੜ ਪਈ ਮੈਂ ਸੋਚਿਆ ਚਲੋ ਮੈਂ ਇੱਕ ਫੋਨ ਦੇਖ ਹੀ ਲੈਂਦੀ ਐਂ ਕਿਆ ਪਤਾ ਮੈਨੂੰ ਸਸਤੇ 'ਚ ਮਿਲ ਜਾਵੇ ਕਿੱਥੇ ਤੋਂ ਫ਼ਿਰ ਮੈਂ ਘਰ ਦੇਖਿਆ ਬਟ ਘਰ ਜਿਹੜਾ ਫ਼ੋਨ ਪਿਆ ਸੀ ਉਹਦੀ ਹਾਲਤ ਬਹੁਤ ਮਾੜੀ ਸੀ ਤਾਂ ਕਰਕੇ ਮੈਂ ਥੋੜ੍ਹਾ ਜਿਹਾ ਸਰਚ ਕਰਨ ਲੱਗੀ ਵੈੱਬਸਾਈਟਸ ਦੇਖੀ ਮੈਂ ਔਨਲਾਈਨ ਸਰਚ ਕੀਤਾ ਤਾਂ ਜਾ ਕੇ ਕਿੱਥੇ ਮੈਨੂੰ ਇੱਕ ਔਫਰ ਦਾ ਪਤਾ ਲੱਗਿਆ ਉਸ ਔਫਰ 'ਚ ਸੀ ਕਿ ਜੇ ਅਸੀਂ ਇੱਕ ਫ਼ੋਨ ਲਉਂਗੇ ਤਾਂ ਇੱਕ ਤਾਂ ਤੀਹ ਪਰਸੈਂਟ ਔਫ ਮਿਲਦਾ ਸੀ ਅਤੇ ਨਾਲ ਹਿ ਨਾਲ ਫ਼ੋਨ ਦੇ ਨਾਲ ਮੈਨੂੰ ਹੈੱਡਫ਼ੋਨਸ ਵੀ ਫ੍ਰੀ ਮਿਲ ਰਹੇ ਸੀ ਜਦ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਉਹਨਾਂ ਨੂੰ ਤਾਂ ਯਕੀਨ ਹੀ ਨਹੀਂ ਆਇਆ ਉਹ ਸੋਚ ਰਹੇ ਸੀ ਯਾ ਤਾਂ ਫੋਨ ਜਿਹੜਾ ਸਾਨੂੰ ਪੀਸ ਮਿਲੂਗਾ ਉਹ ਡਿਫੈਕਟਿਡ ਮਿਲੂਂਗਾ ਯਾ ਫਿਰ ਸਾਡੇ ਪੈਸੇ ਬਰਬਾਦ ਜਾਊਂਗੇ ਅਤੇ ਕੁਝ ਵੀ ਨਹੀਂ ਮਿਲੂਂਗਾ ਬਟ ਫਿਰ ਵੀ ਮੈਂ ਜਿੱਦ ਕਰਕੇ ਫੋਨ ਮੰਗਾ ਹੀ ਲਿਆ ਪਰ ਜਦ ਮੈਨੂੰ ਫ਼ ਹੱਥ ਚ ਫ਼ੋਨ ਆਇਆ ਮੈਂ ਬਿਲਕੁਲ ਹੈਰਾਨ ਹੋ ਗਈ ਫ਼ੋਨ ਇੰਨਾ ਵਧੀਆ ਬਿਲਕੁਲ ਨਵੀਂ ਕੁਆਲਿਟੀ ਦਾ ਨਾ ਹੀ ਸੈਕਿੰਡ ਹੈਂਡ ਬਿਲਕੁਲ ਪੈਕਡ ਸੀਲ ਬੌਕਸ ਵਿੱਚ ਮੈਨੂੰ ਰੀਸਿਵ ਹੋਇਆ ਜਦ ਮੈਂ ਫ਼ੋਨ ਯੂਸ ਕੀਤਾ ਤਦ ਮੈਂ ਦੇਖਿਆ ਕਿ ਫ਼ੋਨ ਦੀ ਪਿਕਸਲਸ ਬਹੁਤ ਜ਼ਿਆਦਾ ਵਧੀਆ ਸੀ ਉਨ ਉਸਦੀ ਰੈਮ ਵੀ ਬਹੁਤ ਵਧੀਆ ਮਿਲੀ ਮੈਨੂੰ ਪੰਜ ਹਜ਼ਾਰ ਮੈਗਾਵੋਰਡ ਦਾ ਚਾਰਜਰ ਨਾਲ ਉਹਦੇ ਨਾਲ ਸਪੇਸ ਵੀ ਮਿਲੀ ਮੈਨੂੰ ਮੈਂ ਫ਼ੋਨ ਨੂੰ ਬਹੁਤ ਜ਼ਿਆਦਾ ਲਾਈਕ ਇੱਕ ਮਹੀਨੇ ਲਈ ਇਸਤੇਮਾਲ ਕਰਕੇ ਦੇਖਿਆ ਕਿ ਚਲੋ ਇੰਨੇ ਪੈਸਿਆਂ ਦਾ ਮੈਨੂੰ ਮਿਲਿਆ ਕਿਆ ਪਤਾ ਫ਼ੋਨ 'ਚ ਕੋਈ ਨਾ ਕੋਈ ਖਰਾਬੀ ਮਿਲ ਜਾਵੇ ਲੇਕਿਨ ਉਹ ਫ਼ੋਨ ਮੈਨੂੰ ਲੱਗਦਾ ਹੈ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੋਨ ਮਿਲਿਆ ਅਤੇ ਪ੍ਰਾਪਤ ਹੋਇਆ ਮੈਂ ਬਹੁਤ ਖੁਸ਼ਨਸੀਬ ਹਾਂ ਕਿ ਫੋਨ ਦੀ ਕੈਮਰਾ ਕੁਆਲਿਟੀ ਪਿੱਚਰ ਕੁਆਲਿਟੀ ਐਂਡ ਹਰ ਇੱਕ ਚੀਜ਼ ਬਿਲਕੁਲ ਪ੍ਰਫੈਕਟ ਮਿਲੀ ਅਤੇ ਉਹਦੇ ਨਾਲ ਹੀ ਨਾਲ ਜਿਹੜੇ ਮੈਨੂੰ ਹੈੱਡਫ਼ੋਨਸ ਫ੍ਰੀ ਵਿੱਚ ਪ੍ਰਾਪਤ ਹੋਏ ਉਹ ਵੀ ਇੱਕਦਮ ਵਧੀਆ ਸੀ ਮੈਂ ਬਹੁਤ ਜ਼ਿਆਦਾ ਆਪਣੇ ਔਡਰ ਤੋਂ ਸੈਟਿਸਫਾਈਡ ਹਾਂ ਅਤੇ ਮੈਂ ਆਸ਼ਾ ਕਰਦੀ ਹਾਂ ਕਿ ਮੇਰੇ ਅੱਗੇ ਆਉਣ ਵਾਲੇ ਔਡਰਸ ਵੀ ਇਦਾਂ ਹੀ ਹੋਣਗੇ